ਮੈਂ ਅੱਜ ਤੋਂ ਇੱਕ ਸਾਲ ਪਹਿਲਾਂ ਹੁੱਡਾ ਬਿਊਟੀ ਦੀ ਲਿਪਸਟਿਕ ਔਨਲਾਈਨ ਖਰੀਦੀ ਸੀਗੀ ਜੋ ਕਿ ਇਸ ਸਾਲ ਵੀ ਚੱਲ ਰਹੀ ਹੈ ਅਤੇ ਉਸਦੀ ਸਭ ਮੇਰੀ ਮੰਮੀ ਅਤੇ ਅਸੀਂ ਸਾਰੇ ਹੀ ਮੇਰੇ ਘਰ ਦੇ ਮੇਰੀਆਂ ਭੈਣਾਂ ਅਸੀਂ ਸਭ ਉਸਦੀ ਵਰਤੋਂ ਕਰਦੇ ਹਨ ਅਤੇ ਉਹ ਬਹੁਤ ਹੀ ਵਧੀਆ ਹੈ